ਹੈਲੋ ਕਮਲਜੀਤ ਜੀ ਕਿਵੇਂ ਓਂ ਵਧੀਆ ਮੈਂ ਨਾ ਤੁਹਾਡੇ ਤੋਂ ਕੁਛ ਪੁੱਛਣਾ ਸੀ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਸੀ ਜਿਹੜੇ ਆਪਣੇ ਕੋਲਜ ਵੱਲੋਂ ਸਟੂਡੈਂਟਸ ਨੂੰ ਸਕੋਲਰਸ਼ਿਪ ਦਿੱਤੀ ਜਾ ਰਹੀ ਹੈ ਜਿਹਨਾਂ ਦੇ ਸੈਵਨਟੀ ਫਾਈਵ ਪਰਸੈਂਟ ਤੋਂ ਵੱਧ ਨੇ ਅਤੇ ਉਹ ਕਿਹੜਾ ਕਿਹੜਾ ਸਟੂਡੈਂਟ ਅਪਲਾਈ ਕਰ ਸਕਦਾ ਅਤੇ ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਦੀ ਆਪਾਂ ਨੂੰ ਲੋੜ ਆ ਸਰਟੀਫਿਕੇਟ ਤਾਂ ਮੇਰੇ ਕੋਲ ਸਾਰੇ ਨੇ ਜੀ ਲੇਕਿਨ ਮੇਰੇ ਨਾ ਡੈਡੀ ਦੀ ਗਵਰਮੈਂਟ ਜੋਬ ਆ ਅਤੇ ਨੰਬਰ ਤਾਂ ਮੇਰੇ ਏਟੀ ਫਾਈਵ ਪਰਸੈਂਟ ਤੋਂ ਅਬਵ ਹੀ ਨੇ ਮਤਲਬ ਸੈਵਨਟੀ ਫਾਈਵ ਕਹਿੰਦੇ ਨੇ ਲੇਕਿਨ ਮੇਰੇ ਏਟੀ ਫਾਈਵ ਤੋਂ ਅਬਵ ਹੀ ਨੇ ਲੇਕਿਨ ਮੇਰੇ ਡੈਡੀ ਦੀ ਗੋਵਰਮੈਂਟ ਜੋਬ ਆ ਅਤੇ ਮੈਂ ਹੁਣ ਸੋਚਦੀ ਹਾਂ ਕਿ ਮੈਂ ਅਪਲਾਈ ਕਰ ਸਕਦੀ ਹਾਂ ਜਾਂ ਨਹੀਂ ਓਕੇ ਅਤੇ ਇਹਦੇ ਲਈ ਕਾਹਦੇ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਓਕੇ ਜੀ ਓਕੇ ਜੀ ਥੈਂਕ ਯੂ ਸੋ ਮਚ ਠੀਕ ਹੈ ਜੀ